ਇੱਕ ਕਲਾਕਾਰ ਦੇ ਰੂਪ ਦੇ ਵਿੱਚ ਮੈਂ ਕੁਛ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਜਿਵੇਂ ਕਿ ਜਦ ਮੈਂ ਆਪਣਾ ਜਿਹੜਾ ਬੱਚਿਆਂ ਨੂੰ ਸਿਖਾਉਣ ਦੇ ਲਈ ਜਿਸ ਸਮਾਨ ਦੀ ਜ਼ਰੂਰਤ ਹੁੰਦੀ ਸੀ ਅਤੇ ਘੱਟ ਪੈਸਿਆਂ ਦੇ ਕਾਰਨ ਜਦ ਉਹ ਸਮਾਨ ਮੈਂ ਨਾ ਖਰੀਦ ਪਾਉਂਦੀ ਤਾਂ ਬੱਚਿਆਂ ਨੂੰ ਸਿਖਾਉਣਾ ਛੁੱਟ ਜਾਂਦਾ ਸੀ ਪਰ ਹੌਲੀ ਹੌਲੀ ਮੈਂ ਆਪਣੇ ਕੰਮ ਨੂੰ ਨੂੰ ਦੇ ਵਿੱਚ ਦਿਲਚਸਪੀ ਰੱਖਦਿਆਂ ਆਪਣੇ ਕੰਮ ਨੂੰ ਵਧਾਵਾ ਦਿੱਤਾ ਅਤੇ ਹੋਰਨਾਂ ਬੱਚਿਆਂ ਨੇ ਹੋਰਨਾਂ ਦੋਸਤਾਂ ਨੇ ਵੀ ਮੇਰੀ ਸਹਾਇਤਾ ਕੀਤੀ ਤਾਂ ਜੋ ਮੈਂ ਆਪਣੇ ਸੁਪਨੇ ਨੂੰ ਪੂਰਾ ਕਰ ਸਕਾਂ ਆਪਣੇ ਚਿੱਤਰਕਾਰੀ ਨੂੰ ਅੱਗੇ ਵਧਾ ਸਕਾਂ